ਮੇਰੀ ਸਭ ਤੋਂ ਵਧੀਆ ਮੈਨੂੰ ਗੇਮ ਫੁੱਟਬੋਲ ਲੱਗਦੀ ਹੈ ਅਸੀਂ ਦੂਰ ਦੂਰ ਖੇਡਣ ਜਾਂਦੇ ਹਾਂ ਕਲੱਬਾਂ ਦੇ ਮੈਚ ਜਿੰਨੇ ਸਾਡੇ ਕਲੱਬਾਂ ਦੇ ਮੈਚ ਫਾਲਦੇ ਹਨ ਅਤੇ ਅਸੀਂ ਜਿੱਤ ਵੀ ਜਿੱਤੇ ਵੀ ਬਹੁਤ ਵਾਰ ਹਾਂ ਅਤੇ ਲੋਕ ਸਾਡੇ ਜਿਹੜੇ ਪਿੰਡ ਮੁੰਡੇ ਹਨ ਐਕਟੀਵਿਟੀ ਵੀ ਹਾਂ ਕਿਵੇਂ ਕੋਚਿੰਗ ਦਿਓ ਸਾਨੂੰ ਖੇਡਣ ਲਈ ਵੀ ਅਸੀਂ ਖੇਡਣਾ ਹੈ ਵੀ ਸਾਨੂੰ ਸਿਖਾਓ ਜੇ ਅਸੀਂ ਜਿੱਤ ਗਏ ਸਾਡੇ ਦੂਰ ਦੂਰ ਤੇ ਸਾਡੇ ਫਿਰ ਪਿੰਡ ਦੇ ਆ ਕੇ ਸਾਡਾ ਸਵਾਗਤ ਕਰਦੇ ਹਨ ਗਲ਼ 'ਚ ਹਾਰ ਪਾਉਂਦੇ ਹਨ ਵੀ ਤੁਸੀਂ ਗੇਮ ਬਹੁਤ ਵਧੀਆ ਖੇਡ ਕੇ ਆਏ ਹੈ ਵੀ ਸਹੀ ਵੀ ਹੈ ਜਿਵੇਂ ਆਪਾਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਦੇ ਜਿਲ੍ਹੇ ਦਾ ਨਾਮ ਰੋਸ਼ਨ ਹੁੰਦਾ ਸਾਡੇ ਕਰਕੇ ਹੀ ਹੁੰਦਾ ਜੇ ਕੋਈ ਸਾਡੇ 'ਚ ਇੱਕ ਵਧੀਆ ਨਿਕਲੂਗਾ ਉਹਦੇ ਕਰਕੇ ਵਧੀਆ ਰਹਿੰਦਾ